ਮੈਂ ਆਪਣੇ ਸਾਈਕਲ ਦੀ ਦੇਖਭਾਲ ਉਸ ਨੂੰ ਚੰਗੇ ਤਰੀਕੇ ਨਾਲ ਧੁਆ ਕੇ ਉਸਦੀ ਚੇਨ 'ਤੇ ਗਰੀਸ ਲਗਾ ਕੇ ਅਤੇ ਉਸਨੂੰ ਪਾਣੀ ਤੋਂ ਦੂਰ ਰੱਖ ਕੇ ਤਾਂ ਕਿ ਉਸ 'ਤੇ ਜੰਗ ਨਾ ਲੱਗੇ ਅਤੇ ਤਰ੍ਹਾਂ ਦੇ ਤਰੀਕਿਆਂ ਨਾਲ ਕਰਦਾ ਹਾਂ ਅਤੇ ਮੈਂ ਇੱਕ ਹੋਰ ਧਿਆਨ ਰੱਖਦਾ ਕਿ ਉਸਦੀਆਂ ਬਰੇਕਾਂ ਵੀ ਮੈਂ ਘਸਾ ਕੇ ਰੱਖਾਂ ਤਾਂ ਕਿ ਜੋ ਮੈਨੂੰ ਜੇਕਰ ਮੈਂ ਕਿਤੇ ਲੰਬੇ ਰੂਟ 'ਤੇ ਜਾਵਾਂ ਅਤੇ ਉਹ ਮੈਨੂੰ ਤੰਗ ਨਾ ਕਰਨ ਅਤੇ ਬਰੇਕਾਂ ਸਹੀ ਢੰਗ ਨਾਲ ਜਿੱਥੇ ਮੈਂ ਲਗਾਉਣਾ ਚਾਹਾਂ ਉੱਥੇ ਲੱਗ ਸਕਣ ਅਤੇ ਜੇਕਰ ਗੱਲ ਕੀਤੀ ਜਾਵੇ ਸਾਈਕਲ ਚਲਾਉਣ ਵਿੱਚ ਥਕਾਵਟ ਹੋ ਸਕਦੀ ਹੈ ਤਾਂ ਹਾਂ ਜੀ ਸਾਈਕਲ ਚਲਾਉਣ ਵੇਲੇ ਮੈਨੂੰ ਕਈ ਵਾਰੀ ਥਕਾਵਟ ਹੋ ਸਕਦੀ ਹੈ ਜੇਕਰ ਮੈਂ ਲੰਬੇ ਰੂਟ 'ਤੇ ਜਾਵਾਂਗਾ ਮੈਨੂੰ ਥਕਾਵਟ ਹੋ ਜਾਂਦੀ ਹੈ ਪਰੰਤੂ ਅਗਰ ਮੈਂ ਕਿਸੇ ਛੋਟੇ ਰੂਟ 'ਤੇ ਜਾਂ ਆਲੇ ਦੁਆਲੇ ਸ਼ਹਿਰ ਵਿੱਚ ਹੀ ਚਲਾਵਾਂ ਤਾਂ ਮੈਨੂੰ ਕੋਈ ਦਿੱਕਤ ਨਹੀਂ ਹੁੰਦੀ ਅਤੇ ਸਾਈਕਲ ਜੇਕਰ ਲੰਬੇ ਰੂਟ 'ਤੇ ਲੈ ਕੇ ਜਾਇਆ ਜਾਵੇ ਤਾਂ ਸਾਨੂੰ ਸੁਚੇਤ ਰਹਿਣਾ ਚਾਹੀਦਾ ਹੈ ਸਾਨੂੰ ਅ ਆਲੇ ਦੁਆਲੇ ਦੇਖ ਕੇ ਚੱਲਣਾ ਚਾਹੀਦਾ ਸਾਨੂੰ ਹੈਲਮਟ ਲਗਾ ਕੇ ਸਾਈਕਲ ਨੂੰ ਚਲਾਉਣਾ ਚਾਹੀਦਾ ਅਤੇ ਸਾਨੂੰ ਜਿਹੜਾ ਸਾਈਕਲ ਨੂੰ ਚੰਗੇ ਤਰੀਕੇ ਨਾਲ ਬੈਲੈਂਸ ਕਰਕੇ ਚਲਾਉਣਾ ਚਾਹੀਦਾ ਹੈ